ਜੀ ਮੈਨੂੰ ਖਾਣਾ ਬਣਾਉਣ ਦੀ ਕਦੇ ਵੀ ਆਫ਼ਤ ਨਹੀਂ ਆਈ ਕਿਉਂਕੀ ਖਾਣਾ ਬਣਾਉਣਾ ਇੱਕ ਮੇਰਾ ਹੋਬੀ ਹੈ ਜੋ ਕਿ ਮੈਂ ਵਿਹਲੇ ਸਮੇਂ ਦੇ ਵਿੱਚ ਕਰਨਾ ਪਸੰਦ ਕਰਦੀ ਹਾਂ ਅਤੇ ਖਾਣਾ ਬਣਾਉਣਾ ਮੇਰੀ ਹੋਬੀ ਨਹੀਂ ਇਹ ਮੇਰਾ ਸ਼ੌਂਕ ਹੈ ਅਤੇ ਮੈਂ ਖਾਣਾ ਬਣਾਉਣ ਲਈ ਹਮੇਸ਼ਾ ਤਿਆਰ ਰਹਿੰਨੀ ਹਾਂ ਚਾਹੇ ਮੈਨੂੰ ਕਿੰਨੇ ਮਰਜ਼ੀ ਲੋਕਾਂ ਦਾ ਖਾਣਾ ਬਣਾਉਣਾ ਪੈ ਜਾਵੇ ਮੈਂ ਕਦੇ ਵੀ ਘਬਰਾਉਂਦੀ ਨਹੀਂ ਹਾਂ ਇਹ ਗੁਣ ਮੈਨੂੰ ਮੇਰੀ ਮਾਂ ਤੋਂ ਮਿਲਿਆ ਹੈ ਅਤੇ ਖਾਣਾ ਬਣਾਉਣਾ ਮੇਰਾ ਸਭ ਤੋਂ ਵੱਡਾ ਸ਼ੌਂਕ ਹੈ ਅਤੇ ਮੈਨੂੰ ਨਵੀਆਂ ਨਵੀਆਂ ਤਰ੍ਹਾਂ ਦੀਆਂ ਰਿਵਾਇਤੀ ਪਕਵਾਨ ਬਣਾਉਣ ਦੀ ਬਹੁਤ ਹੀ ਜ਼ਿਆਦਾ ਸ਼ੌਂਕ ਹੈ ਅਤੇ ਮੈਂ ਮੈਨੂੰ ਖਾਣਾ ਘੱਟ ਪਸੰਦ ਹੈ ਖਾਣਾ ਪਰ ਮੈਨੂੰ ਖਾਣਾ ਬਣਾਉਣ ਦਾ ਬਹੁਤ ਹੀ ਜ਼ਿਆਦਾ ਸ਼ੌਂਕ ਹੈ ਮੈਂ ਕੋਈ ਵੀ ਚੀਜ਼ ਪੰਜ ਦਸ ਮਿੰਟ ਦੇ ਵਿੱਚ ਤਿਆਰ ਕਰ ਲੈਂਦੀ ਹਾਂ ਅਤੇ ਮੈਨੂੰ ਖਾਣਾ ਬਣਾਉਣ ਦੇ ਵਿੱਚ ਬਹੁਤ ਹੀ ਜ਼ਿਆਦਾ ਦਿਲਚਸਪੀ ਹੈ ਜੋ ਕਿ ਇਹ ਗੁਣ ਮੈਨੂੰ ਮੇਰੀ ਮਾਂ ਤੋਂ ਮਿਲਿਆ ਹੈ ਮੇਰੀ ਮਾਂ ਵੀ ਬਹੁਤ ਜ਼ਿਆਦਾ ਵਧੀਆ ਖਾਣਾ ਬਣਾਉਣ ਦੇ ਸ਼ੌਕੀਨ ਹਨ ਅਤੇ ਬਹੁਤ ਹੀ ਜ਼ਿਆਦਾ ਵਧੀਆ ਖਾਣਾ ਬਣਾਉਂਦੇ ਹਨ